ਟੈਕਨੋਲੋਜੀ ਅਤੇ ਇੰਟਰਨੈਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਬਦਲ ਗਈ ਹੈ ਕਿਉਂਕਿ ਟੈਕਨੋਲੋਜੀ ਦੇ ਵਧਣ ਨਾਲ ਇੰਟਰਨੈਟ ਦੀ ਵਰਤੋਂ ਵੱਧ ਗਈ ਹੈ ਅਤੇ ਇੰਟਰ ਵਿੱਚ ਇੰਟਰਨੈਟ ਵਿੱਚ ਸਭ ਤੋਂ ਵੱਧ ਇੰਗਲਿਸ਼ ਅਤੇ ਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਪੰਜਾਬੀ ਭਾਸ਼ਾ ਦਾ ਬਹੁਤ ਹੀ ਘੱਟ ਪ੍ਰਯੋਗ ਕੀਤਾ ਜਾਂਦਾ ਹੈ ਅੱਜ ਕੱਲ੍ਹ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਬਹੁਤ ਘੱਟ ਪੜ੍ਹਾ ਕੇ ਇੰਗਲਿਸ਼ ਅਤੇ ਹਿੰਦੀ ਭਾਸ਼ਾ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਹੌਲੀ ਹੌਲੀ ਬਦਲ ਰਹੀ ਹੈ ਇਸ ਵਿੱਚ ਟੈਕਨੋਲੋਜੀ ਅਤੇ ਇੰਟਰਨੈਟ ਵਿੱਚ ਪੰਜਾਬੀ ਭਾਸ਼ਾ ਦੀ ਬਦਲ ਦੀ ਵਰਤੋਂ ਬਦਲ ਗਈ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਬਦਲ ਕੇ ਇੰਗਲਿਸ਼ ਹਿੰਦੀ ਜਾਂ ਸੰਸਕ੍ਰਿਤ ਫਾਰਸੀ ਫਰਾਂਸ ਸਪੈਨਿਸ਼ ਵਰਗੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਇਸ ਕਰਕੇ ਬਦਲ ਗਈ ਹੈ ਪੰਜਾਬੀ ਭਾਸ਼ਾ ਆਪਣੀ ਮਾਤ ਭਾਸ਼ਾ ਹੈ ਪਰ ਅੱਜ ਕੱਲ੍ਹ ਦੇ ਲੋਕ ਆਪਦੇ ਆਪ ਨੂੰ ਇੱਕ ਆਪਦੇ ਆਪ ਨੂੰ ਇੱਕ ਮਹਾਨ ਅਤੇ ਪੜ੍ਹਨ ਨਾਲ ਇੱਕ ਮਹਾਨ ਅਤੇ ਵੱਡਾ ਆਦਮੀ ਦਿਖਾਉਣ ਲਈ ਇੰਗਲਿਸ਼ ਇੰਗਲਿਸ਼ ਦੀ ਵਰਤੋਂ ਕਰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਘੱਟ ਕਰਦੇ ਹਨ ਟੈਕਨੋਲੋਜੀ ਦੇ ਵੱਧਣ ਨਾਲ ਇੰਟਰਨੈਟ ਦੀ ਮਾਤਰਾ ਜਿਵੇਂ ਵਧੀ ਹੈ ਉਵੇਂ ਹੀ ਪੰਜਾਬੀ ਦੀ ਪੰਜਾਬੀ ਭਾਸ਼ਾ ਇੰਗਲਿਸ਼ ਵਿੱਚ ਬਦਲ ਗਈ ਹੈ ਇੰਗਲਿ ਪੰਜਾਬੀ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਜਾਂਦੀ ਹੈ ਇੰਗਲਿਸ਼ ਭਾਸ਼ਾ ਨੂੰ ਇੰਨਾਂ ਮਹੱਤਵਪੂਰਨ ਸਥਾਨ ਦਿੱਤਾ ਜਾ ਰਿਹਾ ਹੈ ਕਿ ਪੰਜਾਬੀ ਵੀ ਭਾਸ਼ਾ ਨੂੰ ਇੰਗਲਿਸ਼ ਵਿੱਚ ਬਦਲ ਦਿੱਤਾ ਗਿਆ ਹੈ ਇੰ ਟੈਕਨੋਲੋਜੀ ਕਰਕੇ ਲੋਕ ਬਹੁਤ ਹੀ ਮਾਡਰਨ ਹੋ ਗਏ ਆ ਜਿਸ ਕਰਕੇ ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਲੈਤੀ ਜਾਂਦੀ ਅਤੇ ਅੰਗਰੇਜ਼ੀ ਨੂੰ ਜ਼ਿਆਦਾ ਦਿਲਚਸਪੀ ਦਿੱਤੀ ਜਾਂਦੀ ਹੈ